ਖਾਣਾ ਪਕਾਉਣ ਦੇ ਬਣਾਉਣ ਦੇ ਸਕੂਲ ਹੋਣੇ ਚਾਹੀਦੇ ਆ ਜਿਸ ਨਾਲ ਨਵੇਂ ਨੌਜਵਾਨ ਇਹ ਖਾਣਾ ਬਣਾਉਣ ਦੀ ਤਕਨੀਕ ਨੂੰ ਸਿੱਖ ਸਕਣ ਅਤੇ ਅੱਗੇ ਜਾ ਕੇ ਉਹ ਅ ਆਪਣੇ ਰੁਜ਼ਗਾਰ ਪ੍ਰਾਪਤ ਕਰ ਸਕਣ ਜੇ ਇਹਨਾਂ ਬੱਚਿਆਂ ਨੂੰ ਇਹ ਸਿਖਲਾਈ ਦਿੱਤੀ ਜਾਊਗੀ ਤਾਂ ਉਹ ਵਧੀਆ ਢੰਗ ਨਾਲ ਆਪਣਾ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਅਤੇ ਖਾਣਾ ਬਣਾਉਣ ਦੀ ਨਵੀਂ ਨਵੀਂ ਤਕਨੀਕ ਉਹਨਾਂ ਨੂੰ ਦੱਸੀ ਜਾਣੀ ਚਾਹੀਦੀ ਤਾਂ ਕਿ ਬੱਚੇ ਬਾਹਰ ਜਾ ਕੇ ਅੱਗੇ ਜਾ ਕੇ ਉਹਨਾਂ ਨੂੰ ਹੋਰ ਕਿਸੇ ਸ਼ਹਿਰ ਜਾਂ ਪਿੰਡ 'ਚ ਜਾ ਕੇ ਪ੍ਰੋਬਲਮ ਨਾ ਆਵੇ